ਇਕੱਤੀ ਜਨਵਰੀ ਉੱਨੀ ਸੌ ਅਠਾਨਵੇਂ ਪੰਜ ਅਗਸਤ ਦੋ ਹਜ਼ਾਰ ਚਾਰ ਬਾਰ੍ਹਾਂ ਸਤੰਬਰ ਉੱਨੀ ਸੌ ਨੜਿਨਵੇਂ ਚਾਰ ਜੁਲਾਈ ਪੰਦਰ੍ਹਾਂ ਸੌ ਸੱਠ ਉੱਨੀ ਅਗਸਤ ਦੋ ਹਜ਼ਾਰ ਇੱਕ